ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖੋ ਮੈਡਮ ਬੀਜ ਤਾਂ ਬਹੁਤ ਤਰ੍ਹਾਂ ਦੇ ਆਉਂਦੇ ਬਹੁਤ ਕੰਪਨੀਆਂ ਦੇ ਆਉਂਦੇ ਹੈ ਅਤੇ ਸਭ ਤੋਂ ਬੈਸਟ ਬੀਜ ਅੱਜ ਕੱਲ੍ਹ ਸੁਨੀਤਾ ਕੰਪਨੀ ਦੇ ਚੱਲ ਰਿਹਾ ਪੈਦਾਵਾਰ ਵਧੀਆ ਹੋ ਰਹੀ ਹੈ ਪਿਛਲੇ ਸਾਲ ਤੁਸੀਂ ਕਹਿ ਰਹੇ ਸਾਡੇ ਨਰਮਾ ਖ਼ਰਾਬ ਹੋ ਗਿਆ ਪਿਛਲਾ ਸਾਲ ਉਹ ਫਿਰ ਬਾਰਿਸ਼ ਜ਼ਿਆਦਾ ਆਉਣ ਕਰਕੇ ਨਾ ਵਿੱਚ ਸੁੰਡੀਆਂ ਪੈ ਗਈਆਂ ਸੀ ਐਤਕੀ ਬਹੁਤ ਵਧੀਆ ਕੰਪਨੀ ਦਾ ਬੀਜ ਆਈ ਜਾਂਦਾ ਸਾਡੇ ਕੋਲ ਸੁਨੀਤਾ ਕੰਪਨੀ ਦਾ ਬਹੁਤ ਹੈ ਲੋਕ ਲੈ ਕੇ ਜਾਈ ਜਾਂਦੇ ਉਹਨਾਂ ਨੂੰ ਤੁਸੀਂ ਵੀ ਇੱਕ ਵਾਰ ਉਹੀ ਟਰਾਈ ਕਰਕੇ ਦੇਖੋ ਬਹੁਤ ਵਧੀਆ ਕੰਪਨੀ ਦੇ ਬੀਜ ਹੈ ਬਾਕੀ ਜੇ ਬਾ ਹਾਂਜੀ ਹਾਂਜੀ ਹਾਂਜੀ ਹੋਰ ਵੀ ਕੰਪਨੀ ਹੈਗੇ ਹੈਗੇ ਹੈ ਪਰ ਅੱਜ ਕੱਲ੍ਹ ਮਾਰਕੀਟ ਵਿੱਚ ਆਹ ਬੀਜ ਸਭ ਤੋਂ ਜ਼ਿਆਦਾ ਚੱਲ ਰਿਹਾ ਅਤੇ ਹਮ ਤਾਂ ਕੰਪਨੀ ਹੈਗੀ ਹੈ ਇੱਕ ਹੋਰ ਕੰਪਨੀ ਹੈ ਛੋਟਿਆਂ ਦਾ ਨਾਮ ਕੀ ਸੀ ਇੱਕ ਮਿੰਟ ਜੀ ਇੱਕ ਹੋਰ ਕੰਪਨੀ ਆਈ ਬਹੁਤ ਵਧੀਆ ਉਹਨਾਂ ਦਾ ਬੀਜ ਵੀ ਬਹੁਤ ਵਧੀਆ ਮੋਟਾ ਬੀਜ ਹੈ ਪੈਦਾਵਾਰ ਵਧੀਆ ਹੁੰਦੀ ਆ ਨਰਮਾ ਖਿਲ੍ਹ ਕੇ ਆਉਂਦਾ ਉਹ ਬੀਜ ਤੁਸੀਂ ਹਾਂਜੀ ਹਾਂਜੀ ਮੈਡਮ ਪੈਦਾਵਾਰ ਬਹੁਤ ਵਧੀਆ ਹੋਊਗੀ ਤੁਸੀਂ ਕਹੋਗੇ ਸਾਨੂੰ ਵਾਰ ਵਾਰ ਇਹੀ ਬੀਜ ਚਾਹੀਦਾ ਬੀਜ ਬਹੁਤ ਵਧੀਆ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਹਾਂਜੀ ਮੈਡਮ ਸੋਪ ਸੰਡੇ ਨੂੰ ਵੀ ਖੁੱਲ੍ਹੀ ਹੁੰਦੀ ਪਰ ਸ਼ਾਮ ਨੂੰ ਪੰਜ ਵਜੇ ਤੱਕ ਖੁੱਲ੍ਹੀ ਹੁੰਦੀ ਹੈ

ਠੀਕ ਹੈ ਜੀ ਮੈਂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਠੀਕ ਹੈ ਜੀ